ਹੈਲੋ ਭਾਅ ਜੀ ਮੈਂ ਕਮਲਪ੍ਰੀਤ ਕੌਰ ਮਾਨਸਾ ਤੋਂ ਬੋਲਦੀ ਹਾਂ ਮੈਂ ਤੁਹਾਡੇ ਓਲਾ ਤੋਂ ਇੱਕ ਗੱਡੀ ਬੁੱਕ ਕਰਾਈ ਹੈ ਅਸੀਂ ਛੇ ਜਣੇ ਹਾਂ ਤੁਹਾਡੀ ਚਾਰ ਸੀਟਡ ਗੱਡੀ ਦੇ ਵਿੱਚ ਅਸੀਂ ਛੇ ਜਣੇ ਸੈੱਟ ਆ ਸਕਦੇ ਹਾਂ ਜੇਕਰ ਵੱਡੀ ਗੱਡੀ ਹੈ ਛੇ ਸੀਟਡ ਵਾਲੀ ਉਹਦਾ ਵਿੱਚ ਉਹਦਾ ਰੇਟ ਕਿੰਨਾ ਹੈ ਓਕੇ ਛੋਟੀ ਗੱਡੀ ਦਾ ਚਾਰ ਸੌ ਵੱਡੀ ਗੱਡੀ ਦਾ ਪੰਜ ਸੌ ਫਿਰ ਤਾਂ ਭਾਅ ਜੀ ਵੱਡੀ ਗੱਡੀ ਲੈਣ 'ਚ ਹੀ ਫਾਇਦਾ ਹੈ ਇਸ ਲਈ ਭਾਅ ਜੀ ਮੈਂ ਮਾਨਸਾ ਤੋਂ ਫਫੜੇ ਵੀ ਜਾਣਾ ਹੈ ਸਾਡੇ ਉੱਥੇ ਰਿਸ਼ਤੇਦਾਰ ਹਨ ਥੋੜ੍ਹਾ ਟੈਮ ਅਸੀਂ ਰਿਸ਼ਤੇਦਾਰਾਂ ਕੋਲ ਵੀ ਜਾ ਕੇ ਆਉਣਾ ਹੈ ਇਸ ਲਈ ਸਾਨੂੰ ਉੱਥੇ ਰੁਕਣਾ ਪਊਗਾ ਕੁਛ ਟਾਈਮ ਦੇ ਲਈ ਜੇਕਰ ਤੁਸੀਂ ਰੁਕ ਸਕਦੇ ਹੋ ਤਾਂ ਉਹਦੇ ਵਿੱਚ ਤੁਹਾਡਾ ਵੀ ਬੈਨੀਫਿਟ ਹੋਜੂਗਾ ਅਤੇ ਐਂਡ ਅਸੀਂ ਵੀ ਰਿਸਤੇਦਾਰਾਂ ਨੂੰ ਮਿਲ ਲਵਾਂਗੇ ਆਉਣ ਟੈਮ ਵੀ ਅਸੀਂ ਤੁਹਾਡੀ ਗੱਡੀ ਦੇ ਵਿੱਚ ਹੀ ਆਉਣਾ ਹੈ ਸੋ ਇਸ ਲਈ ਤੁਸੀਂ ਵੱਡੀ ਗੱਡੀ ਹੀ ਬੁੱਕ ਕਰ ਦਿਓ ਅਸੀਂ ਛੇ ਜਣੇ ਹਾਂ ਤੁਹਾਡੀ ਵੱਡੀ ਗੱਡੀ ਦੇ ਵਿੱਚ ਸਾਡਾ ਸਾਰਾ ਸਮਾਨ ਅਤੇ ਅਸੀਂ ਛੇ ਜਣੇ ਮਤਲਬ ਸੈੱਟ ਆ ਸਕਦੇ ਹਾਂ ਸੋ ਥੈਂਕਿ ਊ ਜਲਦੀ ਤੋਂ ਜਲਦੀ ਪਲੀਸ ਭਾਅ ਜੀ ਪਹੁੰਚਣ ਦੀ ਕੋਸ਼ਿਸ਼ ਕਰਿਓ ਸਾਨੂੰ ਬਹੁਤ ਹੀ ਜ਼ਿਆਦਾ ਜਲਦੀ ਹੈ ਅਸੀਂ ਮਾਨਸਾ ਤੋਂ ਫਫੜੇ ਭਾਈ ਕੇ ਅੱਜ ਹੀ ਜਾਣਾ ਹੈ ਅਤੇ ਤੁਸੀਂ ਸਾਨੂੰ ਪਹੁੰਚ ਕੇ ਕੌਲ ਕਰ ਦਿਓ ਥੈਂਕਿ ਊ